ਲੰਬੀ ਤੈਰਾਕੀ ਦਾ ਅਭਿਆਸ ਜਿਹੜਾ ਹੈਗਾ ਜੇ ਅਸੀਂ ਲੰਬੀ ਤੈਰਾਕੀ ਕਰਦਾ ਕਰਨਾ ਚਾਹੁੰਦੇ ਹਾਂ ਉਹਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਪ੍ਰੈਕਟਿਸ ਪ੍ਰੈਕਟਿਸ ਵਿੱਚ ਜੇ ਉਹ ਬੰਦਾ ਰੋਜ਼ ਸਵਿਮਿੰਗ ਪੂਲ ਜਾਏਗਾ ਜਾਂ ਫਿਰ ਕਿਸੇ ਇਸ ਤਰ੍ਹਾਂ ਦੀ ਕੋਈ ਸਵਿਮਿੰਗ ਵਾਲੀ ਜਗ੍ਹਾ 'ਤੇ ਜਾਏਗਾ ਤਾਂ ਉਹ ਉਹਨੂੰ ਲੰਬੇ ਤੈਰਾਕੀ ਦਾ ਅਭਿਆਸ ਉਹ ਕਰ ਸਕਦਾ ਹੈ ਜਿਵੇਂ ਕਿ ਉਹਨੂੰ ਜ਼ਰੂਰਤ ਹੈ ਕਿ ਉਹ ਜ਼ਿਆਦਾ ਦੇਰ ਸ ਪਾਣੀ ਵਿੱਚ ਰਹਿ ਸਕੇ ਉਹਦੇ ਉੱਥੇ ਸਾਹ ਜ਼ਿਆਦਾ ਦੇਰ ਰੋਕ ਸਕੇ ਇਹਦੇ ਲਈ ਕੀ ਅ ਅਸੀਂ ਯੋਗਾ ਦਾ ਪੂਰਾ ਆਪਾਂ ਲੈ ਸਕਦੇ ਹਾਂ ਇਸਤੇਮਾਲ ਕਰ ਸਕਦੇ ਹਾਂ ਆਪਾਂ ਯੋਗਾ ਦਾ ਵੱਖਰੇ ਵੱਖਰੇ ਆਸਣ ਹੁੰਦੇ ਨੇ ਯੋਗਾ ਵਿੱਚ ਉਹਦੇ ਸਾਹ ਕੰਟਰੋਲ ਜ਼ਿਆਦਾ ਦੇਰ ਤੱਕ ਕੀਤਾ ਜਾ ਸਕਦਾ ਹੈ ਅਤੇ ਹੋਰ ਕੀ ਹੈ ਕਿਵੇਂ ਅਭਿਆਸ ਜ਼ਿਆਦਾਤਰ ਚਲਾਇਆ ਜਾ ਸਕਦਾ ਜਾਂ ਆਪਾਂ ਇੱਕੋ ਸਟਰੋਕ ਸਿੱਖ ਕੇ ਜਾਵਾਂਗੇ ਤਾਂ ਜ਼ਿਆਦਾ ਦੇਰ ਤੱਕ ਆਪਾਂ ਪਾਣੀ ਵਿੱਚ ਨਹੀਂ ਰਹਿ ਸਕਦੇ ਉਹਨੂੰ ਡਿਫਰੈਂਟ ਡਿਫਰੈਂਟ ਅਲੱਗ ਅਲੱਗ ਸਟਰੋਕਸ ਕਰਨੇ ਚਾਹੀਦੇ ਨੇ ਜਿਵੇਂ ਕਿ ਇੱਕ ਤਾਂ ਹੈਗਾ ਅੰਡਰ ਵਾਟਰ ਡਾਈਵਿੰਗ ਹੋ ਗਈ ਜਿਵੇਂ ਔਰ ਬੈਸਟ ਡਰੋਕ ਹੁੰਦਾ ਬਟਰਫਲਾਈ ਸਟਰੋਕ ਹੁੰਦਾ ਅਲੱਗ ਅਲੱਗ ਸਟਰੋਕਸ ਹੁੰਦੇ ਨੇ ਉਹਨੂੰ ਟਰਾਈ ਕਰਨੇ ਚਾਹੀਦੇ ਨੇ ਇਸ ਤਰ੍ਹਾਂ ਨਾਲ ਅ ਆਪਾਂ ਲੰਬੀ ਤੈਰਾਕੀ ਕਰ ਸਕਦੇ ਹਾਂ ਜ਼ਿਆਦਾ ਦੇਰ ਤੱਕ ਆਪਾਂ ਸਵੀਮਿੰਗ ਕਰ ਸਕਦੇ ਹਾਂ